ਸਾਡੇ ਵੱਲ ਪੰਜਾਬੀ ਭੰਗੜਾ ਅਤੇ ਗਿੱਧਾ ਬਹੁਤ ਮਸ਼ਹੂਰ ਆ ਗਿੱਧੇ ਦੇ ਵਿੱਚ ਕੁੜੀਆਂ ਅਤੇ ਭੰਗੜੇ ਦੇ ਵਿੱਚ ਮੁੰਡੇ ਹੁੰਮ ਹੁੰਮ ਕੇ ਨੱਚਦੇ ਨੇ ਲੇਕਿਨ ਅੱਜ ਕੱਲ ਦੇ ਟਾਇਮ ਦੇ ਵਿੱਚ ਇੱਦਾਂ ਕੋਈ ਵੀ ਰਿਸਟ੍ਰਿਕਸ਼ਨ ਨਹੀਂ ਹੈ ਕਿ ਭੰਗੜਾ ਕੁੜੀਆਂ ਨਹੀਂ ਪਾ ਸਕਦੀਆਂ ਇਸ ਕਰਕੇ ਕੁੜੀਆਂ ਵੀ ਭੰਗੜਾ ਪਾ ਲੈਂਨੇ ਹਾਂ ਮਗਰ ਜਿਵੇਂ ਆਪਾਂ ਦੇਖੀਏ ਕਿ ਸਾਡਾ ਜਿਹੜਾ ਕਲਚਰ ਆ ਉਹਦੇ ਵਿੱਚ ਭੰਗੜਾ ਮੁੰਡੇ ਅਤੇ ਗਿੱਧਾ ਕੁੜੀਆਂ ਪਾਉਂਦੀਆਂ ਨੇ ਲੋਕ ਸਾਡੇ ਇੱਥੇ ਵਿਸਾਖੀ ਔਰ ਆਪਣੀ ਲੋਹੜੀ ਇਹਨਾਂ 'ਤੇ ਹੁੰਮ ਹੁੰਮ ਕੇ ਗਿੱਧੇ ਅਤੇ ਭੰਗੜੇ ਪਾਉਂਦੇ ਨੇ ਔਰ ਖੁਸ਼ਨੁਮਾ ਆਪਣੇ ਪ੍ਰੋਗਰਾਮ ਰਚਾਉਂਦੇ ਨੇ